ਮੈਂ ਜ਼ਿਆਦਾਤਰ ਭੌਤਿਕ ਕਿਤਾਬ ਕਿਤਾਬਾਂ ਨਾਲੋਂ ਵੀ ਕਿਤਾਬਾਂ ਪੜ੍ਹਨੀਆਂ ਜ਼ਿਆਦਾ ਪਸੰਦ ਕਰਦੀ ਹਾਂ ਉਹ ਇਸ ਕਰਕੇ ਪਸੰਦ ਕਰਦੀ ਹਾਂ ਕਿਉਂਕਿ ਜਦੋਂ ਰੀਡਿੰਗ ਬੁੱਕਸ ਜਾਂ ਇਲੈਕਟਰੋਨਿਕਸ ਸੰਸਕਰਣ 'ਚ ਆਪਾਂ ਕਿਤਾਬਾਂ ਪੜ੍ਹਦੇ ਹਾਂ ਤਾਂ ਉਹਦੇ 'ਚ ਸਾਡੀ ਉੱਨੀ ਰੁਚੀ ਨਹੀਂ ਬਣਦੀ ਜਿੰਨੀ ਸਾਡੀ ਕਿਤਾਬਾਂ ਪੜ੍ਹਨ ਦੇ ਵਿੱਚ ਬਣਦੀ ਜਿਵੇਂ ਕਿ ਮੰਨ ਲਓ ਅਸੀਂ ਕਿਸੇ ਕਿਤਾਬ ਦੀ ਜਿਵੇਂ ਮੇਰਾ ਦਾਗਿਸਤਾਨ ਆ ਉਹ ਮੈਂ ਇੱਕ ਕਿਤਾਬ ਪੜ੍ਹ ਲਈ ਉਸ ਤੋਂ ਬਾਅਦ ਜਿਵੇਂ ਮੈਂ ਉਹਦੀ ਆਡੀਓ ਸੁਣਲਾਂਗੀ ਫਿਰ ਹੋ ਸਕਦਾ ਪਰ ਪ੍ਰੈਫਰਸ ਮੈਂ ਆਡੀਓ ਸੁਣਨ ਨੂੰ ਨਹੀਂ ਦਿੰਦੀ ਮੈਂ ਇੱਕ ਸ਼ਾਂਤਮਈ ਜਗ੍ਹਾ 'ਚ ਬੈਠ ਕੇ ਕਿਤਾਬ ਪੜ੍ਹਨ ਨੂੰ ਪ੍ਰੈਫਰਸ ਦਿਵਾਂਗੀ ਜਿਹਦੇ ਵਿੱਚ ਆਡੀਓ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੁਣਨੀ ਜਿਹਦੇ ਵਿੱਚ ਮੈਨੂੰ ਰੀਡਿੰਗ ਕਰਨੀ ਜ਼ਿਆਦਾ ਪਸੰਦ ਆ ਜਿਹਦੇ ਨਾਲ ਸਾਡੀ ਰੀਡਿੰਗ ਸਕਿੱਲ ਵੀ ਵਧਦੀ ਆ ਅਤੇ ਪੜ੍ਹ ਕਿਤਾਬਾਂ ਪੜ੍ਹਨ ਦੇ ਵਿੱਚ ਆਡੀਓ ਬੁੱਕਾਂ ਸੁਣਨ ਦੇ ਵਿੱਚ ਮੈਂ ਜ਼ਿਆਦਾਤਰ ਕਿਤਾਬਾਂ ਪੜ੍ਹਨ ਨੂੰ ਹੀ ਪਹਿਲ ਦੇਵਾਂਗੀ